ਮੀਡੀਆ ਜਾਗਰੂਕਤਾ ਫੈਲਾਉਣ ਵਿੱਚ ਬਹੁਤ ਹੀ ਮਹੱਤਵਪੂਰਨ ਰੱਖਦਾ ਏ ਮੀਡੀਆ ਇੱਕ ਤਰ੍ਹਾਂ ਤਾਂ ਲੋਕਾਂ ਲਈ ਵੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਰੇਡੀਓ ਟੈਲੀਵਿਜ਼ਨ ਰਾਹੀਂ ਅਸੀਂ ਕੁਝ ਵੀ ਸੁਣ ਸਕਦੇ ਹੈ ਜਿਵੇਂ ਕਿ ਜਦ ਕਰੋਨਾ ਹੋਇਆ ਤਾਂ ਉਸ ਟਾਈਮ ਵੀ ਅਸੀਂ ਘਰ ਤੋਂ ਬਾਹਰ ਨਹੀਂ ਜਾ ਸਕਦੇ ਸੀ ਅਸੀਂ ਰੇਡੀਓ ਜਾਂ ਟੈਲੀਵਿਜ਼ਨ 'ਤੇ ਹੀ ਖਬਰਾਂ ਸੁਣਦੇ ਅਤੇ ਜਿੱਦਾਂ ਕਿ ਪੰਜਾਬੀ ਭਾਸ਼ਾ ਵਿੱਚ ਇਹਦਾ ਬਹੁਤ ਹੀ ਮਹੱਤਵਪੂਰਨ ਆ ਜਿਹੜੇ ਲੋਕ ਅਨਪੜ੍ਹ ਹੈ ਉਹ ਮਤਲਬ ਟੀ ਵੀ ਜਾਂ ਰੇਡੀਓ 'ਤੇ ਸੁਣ ਕੇ ਹੀ ਆਪਣਾ ਮਤਲਬ ਸੰਦੇਸ਼ ਉਹ ਕਰ ਸਕਦੇ ਹੈ ਇਹਨਾਂ ਦਾ ਮੀਡੀਆ ਵਾਲਿਆਂ ਦਾ ਬਹੁਤ ਹੀ ਇੱਕ ਮਹੱਤਵਪੂਰਨ ਭੂਮਿਕਾ ਹੈ ਸਾਡੇ ਲਈ ਅਤੇ ਰੇਡੀਓ ਟੈਲੀਵਿਜ਼ਨ ਵਿੱਚ ਅਸੀਂ ਬਹੁਤ ਹੀ ਸੁਣ ਸਕਦੇ ਅਤੇ ਦੇਖ ਸਕਦੇ ਹੈ ਇਹਨਾਂ ਦਾ ਬਹੁਤ ਹੀ ਅਹਿਮ ਰੋਲ ਹੈ ਸਾਡੀ ਜ਼ਿੰਦਗੀ ਵਿੱਚ ਰੇਡੀਓ ਅਤੇ ਟੈਲੀਵਿਜ਼ਨ ਤੋਂ ਅਸੀਂ ਇੱਕ ਦੂਜੇ ਥਾਂ ਦੀ ਖਬਰ ਲੈ ਸਕਦੇ ਆ ਜਾਂ ਦੇ ਸਕਦੇ ਹੈ ਇਹ ਸਾਡੇ ਲਈ ਮੀਡੀਆ ਇੱਕ ਅਹਿਮ ਰੂਪ ਹੈ